ਕੀ ਤੁਸੀਂ ਮਨੋਰੰਜਨ ਖਬਰਾਂ ਵਿੱਚ ਦਿਲਚਸਪੀ ਰੱਖਦੇ ਹੋ ਤੁਸੀਂ ਬਾਲੀਵੁੱਡ ਨਿਊਜ਼ ਕੋਲਮ ਕਿਸੇ ਪਾਰ ਕੋਲੋਂ ਕਰਦੇ ਹੋ ਅਤੇ ਤੁਹਾਨੂੰ ਕਿਸ ਤਰ੍ਹਾਂ ਦੀਆਂ ਖਬਰਾਂ ਸਭ ਤੋਂ ਵੱਧ ਪਸੰਦ ਹਨ ਸੋਸ਼ਲ ਮੀਡੀਆ 'ਤੇ ਮਨੋਰੰਜਨ ਦੀਆਂ ਖਬਰਾਂ ਬਾਰੇ ਤੁਸੀਂ ਕੀ ਸੋਚਦੇ ਹੋ ਹਾਂਜੀ ਮੈਨੂੰ ਮਨੋਰੰਜਨ ਦੀਆਂ ਖਬਰਾਂ ਵਿੱਚ ਥੋੜ੍ਹੀ ਦਿਲਚਸਪੀ ਹੈ ਨਿਊਜ਼ ਕੋਲਮ ਮੈਂ ਕਦੇ ਕਦੇ ਹੀ ਦੇਖਦਾ ਹਾਂ ਖਾਸ ਤੌਰ ਜਦੋਂ ਕਿਸੇ ਨਵੀਂ ਫਿਲਮ ਜਾਂ ਸੰਗੀਤ ਬਾਰੇ ਗੱਲਾਂ ਹੋ ਗੱਲ ਹੋ ਰਹੀ ਹੋਵੇ ਮੈਨੂੰ ਰਮਾ ਅਤੇ ਕਲਾਕਾਰਾਂ ਬਾਰੇ ਜਾਨਣਾ ਚੰਗਾ ਲੱਗਦਾ ਹੈ ਸੋਸ਼ਲ ਮੀਡੀਆ 'ਤੇ ਮਨੋਰੰਜਨ ਦੀਆਂ ਖਬਰਾਂ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ ਜੋ ਕਿ ਚੰਗੀ ਗੱਲ ਹੈ ਹਰ ਕਿਸੇ ਵਾਰ ਅਫਵਾਹਾਂ ਵੀ ਫੈਲ ਜਾਂਦੀਆਂ ਹਨ ਇਸ ਲਈ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਸਿਰਫ ਭਰੋਸੇਯੋਗ ਸਰੋਤਾਂ ਤੋਂ ਹੀ ਜਾਣਕਾਰੀ ਲੈਣੀ ਚਾਹੀਦੀ ਹੈ